ਸਾਡੇ ਅਨੁਸਾਰ ਭੰਗੜਾ ਐਰੋਬਿਕਸ ਨੂੰ ਮਜ਼ੇਦਾਰ ਬਣਾਉਣ ਬਣਾਉਣ ਵਿੱਚ ਸੰਗੀਤ ਬਹੁਤ ਹੀ ਜ਼ਿਆਦਾ ਭੂਮਿਕਾ ਨਿਭਾਉਂਦਾ ਹੈ ਕਿਉਂਕਿ ਬਿਨ੍ਹਾਂ ਸੰਗੀਤ ਤੋਂ ਭੰਗੜਾ ਹੋਈ ਹੀ ਨਹੀਂ ਸਕਦਾ ਨਹੀਂ ਆਇਓ ਐਰੋਬੈਕਸ ਵੈਕਸ ਭੰਗੜਾ ਵਿੱਚ ਕਿਸੇ ਖ਼ਾਸ ਸੰ ਸੰਗੀਤ ਦੀ ਵਰਤੋਂ ਨਹੀਂ ਕੀਤੀ ਜਾਂਦੀ ਹੈ ਸਗੋਂ ਜੋ ਵੀ ਸੰਗੀਤ ਜ਼ਿਆਦਾ ਮਸ਼ਹੂਰ ਜਾਂ ਦਿਲਚਸਪ ਹੋਵੇ ਉਸ ਨੂੰ ਵਰਤਿਆ ਜਾਂਦਾ ਹੈ ਤਾਂ ਕਿ ਲੋਕ ਇਸ ਇਸ ਵਿੱਚ ਜ਼ਿਆਦਾ ਤੋਂ ਜ਼ਿਆਦਾ ਭਾਗ ਲੈ ਸਕਣ ਅਤੇ ਅਨੰਦ ਪ੍ਰਾਪਤ ਕਰ ਸਕਣ ਅਤੇ ਚੰਗੀ ਸਿਹਤ ਵੱਲ ਆਪਣਾ ਕਦਮ ਵਧਾ ਸਕਣ